ਪਟਿਆਲੇ ਸ਼ਹਿਰ ਵਿੱਚ ਅਜਿਹੀਆਂ ਕਈ ਰੀਤੀ ਰਿਵਾਜ਼ਾਂ ਅਤੇ ਤੇ ਸੱਭਿਆਚਾਰਿਕ ਗਤੀਵਿਧੀਆਂ ਨੇ ਜਿਹੜੀਆਂ ਕਿ ਪੰਜਾਬੀ ਭਾਈਚਾਰੇ ਨੂੰ ਦਰਸਾਉਂਦੀਆਂ ਨੇ ਜਿਵੇਂ ਕਿ ਪਟਿਆਲਾ ਹੈਰੀਟੇਜ ਮੇਲਾ ਇਹ ਮੇਲਾ ਹਰ ਸਾਲ ਅਪ੍ਰੈਲ ਦੇ ਮਹੀਨੇ ਵਿੱਚ ਸ਼ੀਸ਼ ਮਹਿਲ ਵਿਖੇ ਲੱਗਦਾ ਹੈ ਅਤੇ ਇੱਥੇ ਬਹੁਤ ਸਾਰੇ ਕਾਰੀਗਰ ਆਪਣਾ ਹੱਥੀਂ ਬਣਿਆ ਸਮਾਨ ਲੈ ਕੇ ਆਉਂਦੇ ਹਨ ਅਤੇ ਬਹੁਤ ਸਾਰੇ ਹੀ ਕਾਰੀਗਰਾਂ ਨੂੰ ਇੱਥੇ ਸਨਮਾਨਿਤ ਵੀ ਕੀਤਾ ਜਾਂਦਾ ਹੈ ਅਤੇ ਇਸ ਮੇਲੇ ਨੂੰ ਦੇਖਣ ਲਈ ਦੂਰ ਦੂਰ ਸ਼ਹਿਰਾਂ ਤੋਂ ਲੋਕ ਖਾਸ ਆਉਂਦੇ ਨੇ ਪਟਿਆਲੇ ਦੇ ਵਿੱਚ ਅਤੇ ਉਹ ਇਸ ਮੇਲੇ ਦੀ ਰੰਗ ਰੂਪ ਅਤੇ ਇਸ ਮੇਲੇ ਦੀ ਸਜਾਵਟ ਨੂੰ ਦੇਖ ਸਕੀਏ ਔਰ ਸਭ ਤੋਂ ਵੱਡੀ ਸਮੱਸਿਆ ਉੱਥੇ ਆਉਂਦੀ ਹੈ ਜਿੱਥੇ ਲੋਕਾਂ ਦਾ ਇਕੱਠ ਜ਼ਿਆਦਾ ਹੋ ਜਾਂਦਾ ਹੈ ਅਤੇ ਕਿਉਂਕਿ ਜਗ੍ਹਾ ਘੱਟ ਹੋਣ ਕਾਰਨ ਇੱਥੇ ਕਾਫੀ ਰਸ਼ ਇਕੱਠਾ ਹੋ ਜਾਂਦਾ ਅਤੇ ਲੋਕਾਂ ਨੂੰ ਸੰਭਾਲਣਾ ਬਹੁਤ ਔਖਾ ਹੋ ਜਾਂਦਾ ਅਤੇ ਉੱਥੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਆਪਸੀ ਸਾਂਝ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨਾਲ ਇਸ ਸਮੱਸਿਆ ਨੂੰ ਹੱਲ ਕਰਨ ਅਤੇ ਇਸ ਦੇ ਵਿੱਚ ਬਣਦਾ ਯੋਗਦਾਨ ਪਾਉਣ